ਮੈਂ ਹਰਜੀਤ ਕੌਰ ਗੁਰਦਾਸਪੁਰ ਤੋਂ ਬੋਲਦੀ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਸਰਕਾਰੀ ਐਪ ਆ ਮੇਰਾ ਜਿਹੜਾ ਰਾਸ਼ਨ ਕਾਰਟ ਹੈਗਾ ਵਾ ਜੇ ਕਿਤੇ ਮੈਨੂੰ ਕੋਈ ਪ੍ਰੋਬਲਮ ਆ ਜਾਂਦੀ ਆ ਜਿੱਦਾਂ ਰਾਸ਼ਨ ਕਣਕ ਵਗੈਰਾ ਰਾਸ਼ਨ ਉੱਥੋਂ ਲੈਣਾ ਹੁੰਦਾ ਵਾ ਡੀਪੂਆਂ ਦੇ ਉੱਤੋਂ ਜੋ ਮੈਨੂੰ ਨਾ ਮਿਲੇ ਜਾਂ ਮੈਨੂੰ ਪਤਾ ਨਾ ਲੱਗੇ ਜਾਂ ਉਹ ਵਿੱਚ ਹੇਰਾਫੇਰੀ ਹੋਈ ਹੋਵੇ ਉਹਦੇ ਵਿੱਚ ਮੈਂ ਮਤਲਬ ਕਿ ਇਹਦਾ ਰਾਸ਼ਨ ਕਾਰਟ ਦਾ ਇਹ ਜਿ ਇਹ ਐਪ ਮੈਂ ਵਰਤਦੀ ਹਾਂ ਉੱਥੇ ਤੋਂ ਮੈਨੂੰ ਹਰ ਚੀਜ਼ ਦਾ ਪਤਾ ਚੱਲ ਜਾਂਦਾ ਵਾ ਵੀ ਮਤਲਬ ਕਿ ਕਣਕ ਦੇ ਵਿੱਚ ਕੋਈ ਹੇਰਾ ਫੇਰੀ ਜਾਂ ਕੋਈ ਕਣਕ ਵੀ ਮਿਲਦੀ ਆ ਜਾਂ ਕੀ ਹਿਸਾਬ ਕਿਤਾਬ ਹੈਗਾ ਉਹ ਮੈਂ ਸਾਰਾ ਹੀ ਆਪਣੇ ਮਤਲਬ ਕਿ ਐਪ ਦੇ ਰਾਹੀਂ ਵੀ ਰੱਖਿਆ ਹੋਇਆ ਉੱਥੋਂ ਮੈਂ ਵੇਖ ਲੈਂਦੀ ਹਾਂ ਅੱਗੇ ਹੈਗਾ ਵਾ ਕਿ ਸੇਵਾ ਕੇਂਦਰ ਜਿਹੜਾ ਵਾ ਉਹ ਵੀ ਸਰਕਾਰੀ ਐਪ ਹੈਗਾ ਉਹਦੇ ਵਿੱਚ ਸੇਵਾ ਕੇਂਦਰ 'ਚੋਂ ਵੀ ਜਿੱਥੋਂ ਜਿੱਦਾਂ ਸਾਡਾ ਕੁਛ ਵੀ ਗਲਤ ਆਧਾਰ ਕਾਰਟ ਵਗੈਰਾ ਗਲਤ ਕੁਛ ਵੀ ਹੋਵੇ ਉੱਥੇ ਜਾ ਕੇ ਹੀ ਮਤਲਬ ਕਿ ਠੀਕ ਕਰਵਾ ਕਰਵਾ ਲੈਂਦੀ ਹਾਂ ਉੱਥੋਂ ਹੀ ਸਾਰਾ ਕੁਛ ਪਤਾ ਜਾਣਕਾਰੀ ਹਾਸਲ ਕਰ ਸ ਕਰ ਲੈਂਦੇ ਹਾਂ ਜਿਹੜਾ ਇੱਕ ਹੈਗਾ ਵਾ ਕਿ ਡਾਕੂਮੈਂਟ ਡਿਜੀਲੋਕਰ ਹੈਗਾ ਉਹ 'ਚ ਮੈਂ ਆਪਣੇ ਬੱਚਿਆਂ ਦੇ ਆਪਣੇ ਮਤਲਬ ਕਿ ਸਾਰੇ ਆਪਣੇ ਸਰਟੀਫਿਕੇਟ ਕੀ ਜੋ ਬੱਚੇ ਪੜ੍ਹਦੇ ਉਹਨਾਂ ਦੇ ਸਾਰੇ ਹੀ ਮ ਰੱਖਿਆ ਵਾ ਡਾਕੂਮੈਂਟ ਉੱਥੇ ਜਮ੍ਹਾਂ ਐਪ ਵਿੱਚ ਸਾਰਾ ਕੁਝ ਰੱਖਿਆ ਜਦੋਂ ਵੀ ਕੋਈ ਪਤਾ ਹ ਹੋਣਾ ਹੋਵੇ ਤਾਂ ਉੱਥੋਂ ਅਸੀਂ ਐਪ ਤੋਂ ਵੇਖ ਸਕਦੇ ਹਾਂ ਹਰ ਚੀਜ਼ ਉੱਥੋਂ ਹੀ ਕਰ ਸਕਦੇ ਹਾਂ ਮੇਰੇ ਵਿੱਚ ਜਿਹੜਾ ਰਾਸ਼ਨ ਕਾਰਟ ਹੈਗਾ ਵਾ ਰਾਸ਼ਨ ਕਾਰਟ ਵੀ ਇੱਕ ਸਰਕਾਰੀ ਮਤਲਬ ਕਿ ਹੈਗਾ ਜੀ ਇੱਥੋਂ ਕੋਈ ਹੇਰਾ ਫੇਰੀ ਜਾਂ ਕੋਈ ਕਣਕ ਵਗੈਰਾ ਨਹੀਂ ਮਿਲਦੀ ਜਾਂ ਕੁਛ ਵੀ ਹੈਗਾ ਉੱਥੋਂ ਮੈਂ ਹਰ ਚੀਜ਼ ਦੀ ਹਰ ਚੀਜ਼ ਦਾ ਪਤਾ ਕਰ ਲੈਂਦੀ ਹਾਂ ਅਤੇ ਜੋ ਆਧਾਰ ਕਾਰਟ ਵੀ ਆਧਾਰ ਕਾਰਟ ਪਹਿਲਾਂ ਸਾਡਾ ਇੱਕ ਵਾਰੀ ਮਤਲਬ ਕਿ ਥੋੜ੍ਹਾ ਜਿਹਾ ਗੁੰਮ ਹੋ ਗਏ ਸੀ ਉੱਥੋਂ ਵੇਖਿਆ ਵੀ ਐਪ ਦੇ ਵਿੱਚੋਂ ਸਾਰਾ ਕਰਕੇ ਅਤੇ ਉਹਦੇ ਵਿੱਚੋਂ ਸਾਨੂੰ ਸਾਰਾ ਕੁਛ ਪ ਪਤਾ ਲੱਗ ਗਿਆ ਵਾ ਵੀ ਇਸ ਕਰਕੇ ਹਰ ਚੀਜ਼ ਜਿਹੜੀ ਹੈਗੀ ਆ ਅਤੇ ਉੱਥੋਂ ਹੀ ਵਿੱਚ ਐਪ ਤੋਂ ਹੀ ਵੇਖ ਲੈਂਦੇ ਹਾਂ ਸਾਰਾ ਕੁਛ ਉੱਥੋਂ ਹੀ ਕਰ ਲੈਂਦੇ ਹੈਗੇ ਹਾਂ ਅਤੇ